ਬਾਗਬਾਨੀ ਦੀ ਸ਼ੁਰੂਆਤ ਮੈਂ ਆਪਣੇ ਮਾਤਾ ਪਿਤਾ ਤੋਂ ਸੁਣ ਕੇ ਅਤੇ ਸਕੂਲ ਅਤੇ ਕਾਲਜ ਦੇ ਵਿੱਚ ਵੱਖ ਵੱਖ ਤਰ੍ਹਾਂ ਦੇ ਸੈਮੀਨਾਰ ਮੈਂ ਦੇਖੇ ਜਿਸ ਤੋਂ ਬਾਅਦ ਮੈਨੂੰ ਬਾਗਬਾਨੀ ਦੇ ਵਿੱਚ ਦਿਲਚਸਪੀ ਹੋਈ ਸਭ ਤੋਂ ਪਹਿਲਾਂ ਮੈਂ ਘਰ ਦੀ ਬਗੀਚੀ ਦੇ ਵਿੱਚ ਦੀ ਦੇਖਭਾਲ ਕਰਨ ਲੱਗਿਆ ਜਿਸ ਦੀ ਦੇਖਭਾਲ ਪਹਿਲਾਂ ਸਾਡੇ ਮਾਲੀ ਕਰਦਾ ਸੀ ਮਾਲੀ ਦਾ ਕੰਮ ਰੋਕ ਕੇ ਮੈਂ ਇਹ ਕੰਮ ਆਪਣੇ ਹੱਥੀਂ ਕਰਨਾ ਸ਼ੁਰੂ ਕੀਤਾ ਅਤੇ ਪੌਦਿਆਂ ਦੇ ਨਾਲ ਮੈਨੂੰ ਪਿਆਰ ਹੋ ਗਿਆ ਇਸ ਤਰ੍ਹਾਂ ਹੀ ਵੱਖ ਵੱਖ ਤਰ੍ਹਾਂ ਦੇ ਮੈਂ ਪੌਦੇ ਨਰਸਰੀ ਦੇ ਵਿੱਚੋਂ ਖਰੀਦ ਕੇ ਲਿਆਉਂਦਾ ਅਤੇ ਆਪਣੀ ਬਗੀਚੀ ਦੇ ਵਿੱਚ ਲਗਾਉਂਦਾ ਜਿਸ ਤਰ੍ਹਾਂ ਮੈਨੂੰ ਉਸ ਨੂੰ ਪਾਲਣ ਪੋਸ਼ਣ ਕਰਨ ਦੇ ਵਿੱਚ ਬੜਾ ਸਕੂਨ ਮਿਲਦਾ ਇਸ ਦੇ ਬਾਅਦ ਅਸੀਂ ਇਸ ਕੰਮ ਨੂੰ ਵੱਡੇ ਪੱਧਰ 'ਤੇ ਵੀ ਸ਼ੁਰੂ ਕੀਤਾ ਖੇਤਾਂ ਦੇ ਵਿੱਚ ਜਾ ਕੇ ਅਸੀਂ ਵੱਖ ਵੱਖ ਤਰ੍ਹਾਂ ਦੇ ਦਰਖਤ ਲਗਾਏ ਤਾਂ ਜੋ ਉਸ ਨੂੰ ਵੀ ਪਾਣੀ ਦੇਣਾ ਅਤੇ ਕਿਸੇ ਤਰੀਕੇ ਦੀ ਖਾਦ ਪਾਉਣੀ ਇਹ ਕੰਮ ਵੀ ਅਸੀਂ ਆਪਣੇ ਹੱਥੀਂ ਸ਼ੁਰੂ ਕੀਤਾ ਬਾਗਬਾਨੀ ਦੇ ਵਿੱਚ ਸਾਡੀ ਦਿਲਚਸਪੀ ਇੱਥੋਂ ਤੱਕ ਵੱਧ ਗਈ ਸੀ ਕਿ ਅਸੀਂ ਲੋਕਾਂ ਦੀਆਂ ਬਗੀਚੀਆਂ ਵੀ ਸੰਵਾਰਨ ਲੱਗ ਗਏ ਅਤੇ ਲੋਕਾਂ ਨੂੰ ਇਸ ਚੀਜ਼ ਬਾਰੇ ਦੱਸਣ ਲੱਗ ਪਏ ਮੰਦਰਾਂ ਗੁਰਦੁਆਰਿਆਂ ਦੇ ਵਿੱਚ ਵੱਖ ਵੱਖ ਤਰ੍ਹਾਂ ਦੇ ਫਲਦਾਰ ਅਤੇ ਫੁੱਲ ਵਾਲੇ ਬੂਟੇ ਅਸੀਂ ਲਗਾਉਣੇ ਸ਼ੁਰੂ ਕਰ ਦਿੱਤੇ ਬਚਪਨ ਤੋਂ ਹੀ ਇਹ ਬਗੀਚੀ ਦਾ ਕੰਮ ਕਰ ਕਰ ਕੇ ਬਾਗਬਾਨੀ ਦੇ ਵਿੱਚ ਸਾਡਾ ਇੰਨਾਂ ਕੁ ਤਜ਼ਰਬਾ ਹੋ ਗਿਆ ਕਿ ਅਸੀਂ ਹੁਣ ਕਿਸੇ ਵੀ ਬੂਟੇ ਤੋਂ ਇੱਕ ਹੋਰ ਬੂਟਾ ਤਿਆਰ ਕਰਨਾ ਬੀਜ ਤੋਂ ਕੋਈ ਫਲਦਾਰ ਬੂਟਾ ਤਿਆਰ ਕਰਨਾ ਫੁੱਲਾਂ ਵਾਲੇ ਬੂਟੇ ਦੀ ਸਾਂਭ ਸੰਭਾਲ ਕਰਨੀ ਬੇਲਾਂ ਦੀ ਸਾਂਭ ਸੰਭਾਲ ਕਰਨੀ ਜਿਸ ਤਰ੍ਹਾਂ ਦਾ ਕੰਮ ਅਸੀਂ ਆਪਣੇ ਆਪ ਸਿੱਖ ਲਿਆ ਹੁਣ ਇਹ ਕੰਮ ਅਸੀਂ ਵੱਡੇ ਪੱਧਰ 'ਤੇ ਆਪਣੇ ਖੇਤਾਂ ਦੇ ਵਿੱਚ ਬਾਗ ਲਗਾ ਕੇ ਸ਼ੁਰੂ ਕਰਨ ਦੀ ਸੋਚ ਰਹੇ ਹਾਂ ਮੇਰਾ ਬਚਪਨ ਤੋਂ ਹੀ ਜੋ ਤਜ਼ਰਬਾ ਸੀ ਉਹ ਇਸ ਵਿੱਚ ਜ਼ਰੂਰ ਕੰਮ ਆਵੇਗਾ ਬਾਗਬਾਨੀ ਹਰ ਇੱਕ ਇਨਸਾਨ ਨੂੰ ਕਰਨੀ ਚਾਹੀਦੀ ਹੈ ਇਸ ਦੇ ਵਿੱਚ ਇੱਕ ਅਲੱਗ ਸਕੂਨ ਹੈ ਜਿਹਨਾਂ ਦਾ ਪੌਦਿਆਂ ਨਾਲ ਪਿਆਰ ਪੈ ਗਿਆ ਉਹਨਾਂ ਨੂੰ ਇਸ ਦੁਨੀਆਂ ਦੇ ਵਿੱਚ ਬਹੁਤ ਪਿਆਰ ਲੋਕਾਂ ਤੋਂ ਵੀ ਮਿਲਦਾ ਹੈ ਅਤੇ ਉਹ ਆਪਣੇ ਮਨ ਨੂੰ ਵੀ ਸ਼ਾਂਤ ਰੱਖਦੇ ਹਨ